ਇਸ ਖੇਤਰ ਵਿੱਚ ਅਕਸਰ ਦੇਖੇ ਜਾਣ ਵਾਲੇ ਬਹੁਤ ਸਾਰੇ ਪੰਛੀ ਹਨ ਜਿਵੇਂ ਚਿੜੀਆਂ ਤੋਤੇ ਘੁੱਗੀ ਬਾਜ ਮੋਰ ਮੋਰਨੀਆਂ ਅਲੱਗ ਅਲੱਗ ਤਰ੍ਹਾਂ ਦੇ ਪੰਛੀ ਹਨ ਪਰ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਚਿੜੀਆਂ ਤੋਤੇ ਅਤੇ ਕੋਇਲ ਮੋਰ ਇਹ ਲੱਗਦੇ ਹਨ ਕਿਉਂਕਿ ਜਦੋਂ ਸਵੇਰ ਨੂੰ ਜਦੋਂ ਸ ਸਵੇਰੇ ਸਵਖਤੇ ਵੇਲੇ ਜਦੋਂ ਚਿੜੀਆਂ ਚੀਂ ਚੀਂ ਕਰਦੀਆਂ ਤਾਂ ਉਹਨਾਂ ਦੇ ਉਹ ਅਲੱਗ ਹੀ ਆਨੰਦ ਦਿੰਦੀਆਂ ਹਨ ਸੁਣ ਕੇ ਬਹੁਤ ਸਕੂਨ ਮਿਲਦਾ ਉਹਨਾਂ ਦੀ ਚੀਂ ਚੀਂ ਨੂੰ ਅਤੇ ਜਿਹੜੀ ਕੋਇਲ ਹੈ ਉਹਦੀ ਉਹ ਬਹੁਤ ਸੋਹਣਾ ਮਤਲਬ ਉਹਦੇ ਸੁਰ ਬਹੁਤ ਸੋਹਣੇ ਗਾ ਗਾਉਂਦੀ ਹੈ ਉਹ ਜਦੋਂ ਸਵੇਰੇ ਉੱ ਉੱਠ ਕੇ ਅਤੇ ਜਿਹੜੀ ਜਿਹੜੇ ਮੋਰ ਹੈ ਜਦੋਂ ਇਹ ਪੈਲਾਂ ਪਾਉਂਦੇ ਵੀ ਅਲੱਗ ਹੀ ਨਜ਼ਾਰਾ ਦਿੰਦੇ ਆ ਜਦੋਂ ਇਨ ਜਦੋਂ ਇਹਨਾਂ ਨੂੰ ਦੇਖਦਾ ਹੈ ਅਤੇ ਇਹ ਅਲੱਗ ਹੀ ਖੁਸ਼ੀ ਮਿਲਦੀ ਹੈ ਇਹਨਾਂ ਨੂੰ ਅੰਦਰੋਂ ਦੇਖ ਕੇ ਅਤੇ ਤੋ ਤੋ ਤੋਤੇ ਨੂੰ ਦੇਖ ਤੋਤਾ ਦੇਖਣ ਨੂੰ ਬਹੁਤ ਵਧੀਆ ਲੱਗਦਾ ਹੈ ਅਤੇ ਉਹਨੂੰ ਦੇਖ ਕੇ ਵੀ ਅਲੱਗ ਹੀ ਖੁਸ਼ੀ ਮਿਲਦੀ ਹੈ ਅਤੇ ਜਿਹੜੇ ਪੰਛੀ ਜਦੋਂ ਉੱਡਦੇ ਹੈ ਇਹ ਅਲੱਗ ਹੀ ਖੁਸ਼ੀ ਦਿੰਦੇ ਆਸਮਾਨ 'ਚ ਅਲੱਗ ਤਰ੍ਹਾਂ ਦੇ ਲੱਗਦੇ ਹੈ ਅਤੇ ਜਿਹਦੇ ਨਾਲ ਅੰਦਰੋਂ ਬਹੁਤ ਖੁਸ਼ੀ ਹੁੰਦੀ ਹੈ ਦੇਖ ਦੇਖਣ ਨੂੰ ਵੀ ਆਜ਼ਾਦ ਪੰਛੀਆਂ ਨੂੰ ਦੇਖ ਕੇ ਬਹੁਤ ਅਲੱਗ ਤਰ੍ਹਾਂ ਦੀ ਖੁਸ਼ੀ ਮਿਲਦੀ ਹੈ